ਮੇਰੇ ਘਰ ਕੋਈ ਮਹਿਮਾਨ ਆਉਂਦੇ ਨੇ ਪਹਿਲੀ ਚੀਜ਼ ਤਾਂ ਮੈਨੂੰ ਉਹਨਾਂ ਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਮਹਿਮਾਨ ਜਿਹੜੇ ਨੇ ਸਪੈਸ਼ਲ ਸਾਨੂੰ ਮਿਲਣ ਲਈ ਆਉਂਦੇ ਨੇ ਸਾਡੇ ਨਾਲ ਸਮਾਂ ਬਿਤਾਉਣ ਲਈ ਆਉਂਦੇ ਨੇ ਤਾਂ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਜਿਵੇਂ ਦਾ ਵੀ ਪਸੰਦ ਹੁੰਦਾ ਮੈਂ ਉਵੇਂ ਦਾ ਹੀ ਬਣਾਉਣਾ ਪਸੰਦ ਕਰਦੀ ਹਾਂ ਪਹਿਲੀ ਚੀਜ਼ ਤਾਂ ਮੈਂ ਉਹਨਾਂ ਲਈ ਪਕੌੜੇ ਜ਼ਰੂਰ ਬਣਾਉਂਦੀ ਹਾਂ ਚਾਹ ਦੇ ਨਾਲ ਪਕੌੜੇ ਦੇਣੇ ਉਸ ਤੋਂ ਬਾਅਦ ਫਿਰ ਨਾਸ਼ਤੇ ਦੇ ਵਿੱਚ ਅਸੀਂ ਜ਼ਿਆਦਾਤਰ ਆਲੂ ਵਾਲੇ ਪਰੌਂਠੇ ਬਣਾਉਦੇ ਹਾਂ ਜਾਂ ਕਈ ਵਾਰੀ ਛੋਲੇ ਪੂਰੀਆਂ ਬਣਾ ਲਿੱਤੀਆਂ ਜਾਂਦੀਆਂ ਨੇ ਜਿਹੜੇ ਘਰ ਦਾ ਭੋਜਨ ਖਾਣਾ ਪਸੰਦ ਕਰਦੇ ਨੇ ਉਹਨਾਂ ਨੂੰ ਘਰਵਾਲੀ ਜਾਂਦੀ ਆ ਪੰਜਾਬ ਵਾਲੇ ਜਿੱਦਾਂ ਨੇ ਉਹ ਖਵਾਈਆਂ ਜਾਂਦੀਆਂ ਨੇ ਅਤੇ ਜੇ ਬੱਚੇ ਨਾਲ ਆਉਣ ਬੱਚੇ ਪਸੰਦ ਕਰਦੇ ਨੇ ਨੂਡਲਸ ਵਗੈਰਾ ਬਣਾਉਣੇ ਤਾਂ ਉਹ ਵੀ ਬਣਾ ਕੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ ਪਾਓ ਭਾਜੀ ਬਣਾਈ ਦੀ ਹੈ ਬੜੇ ਚਾਅ ਦੇ ਨਾਲ ਬੱਚਿਆਂ ਲਈ ਵੀ ਕਿਉਂਕਿ ਇਹ ਬੱਚੇ ਆਰਾਮ ਨਾਲ ਖਾ ਲੈਂਦੇ ਨੇ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਬਣਾ ਦਿਓ ਸਬਜ਼ੀਆਂ ਦਾ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣ ਦੇ ਦੇਈਦਾ ਉਹਦੇ ਵਿੱਚ ਕਿਹੜੀ ਸਬਜ਼ੀ ਪਾਈ ਹੋਈ ਆ ਕਈ ਵਾਰ ਬੱਚੇ ਪਸੰਦ ਨਹੀਂ ਕਰਦੇ ਸਬਜ਼ੀਆਂ ਤਾਂ ਇਸ ਕਰਕੇ ਇਹਨਾਂ ਨੂੰ ਮਿਕਸ ਕਰਕੇ ਖਵਾ ਦਿੱਤੀ ਜਾਂਦੀ ਹੈ ਅਤੇ ਨਾਲ ਮਿੱਠਾ ਬਣਾਉਣਾ ਕੁਝ ਜ਼ਰੂਰੀ ਹੁੰਦਾ ਸਾਡੇ ਘਰਾਂ ਦੇ ਵਿੱਚ ਕਈ ਵਾਰੀ ਕਸਟਡ ਬਣਾ ਲਈ ਦਾ ਫਰੂਟ ਕਸਟਡ ਜਾਂ ਸੇਵੀਆਂ ਬਣਾ ਲਈ ਦੀਆਂ ਨੇ ਦੁੱਧ ਦੇ ਵਿੱਚ ਪਾ ਕੇ ਕਈ ਵਾਰੀ ਤੜਕੇ ਵਾਲੀਆਂ ਸੇਵੀਆਂ ਬਣਾ ਲਈ ਦੀਆਂ ਨੇ ਜਾਂ ਮਿੱਠੇ ਚਾਵਲ ਬਣਾਈ ਦੇ ਨੇ ਜ਼ਰੂਰ ਬਣਾਈ ਦੇ ਨੇ ਨਾਲ ਛੋਲਿਆਂ ਦੀ ਸਬਜ਼ੀ ਅਤੇ ਨਾਲ ਤੰਦੂਰ ਵਾਲੀ ਰੋਟੀ ਵੀ ਬਣਾ ਲਈ ਦੀ ਹੈ ਅਤੇ ਸਾਡੇ ਘਰਾਂ ਦੇ ਵਿੱਚ ਇੱਕ ਜ਼ਿਆਦਾ ਜ਼ਰੂਰੀ ਇਹ ਹੈ ਕਿ ਵਿੱਚ ਪਨੀਰ ਪਾਉਣਾ ਹੁੰਦਾ ਫਿਰ ਉ ਪਨੀਰ ਵਾਲੀ ਸਬਜ਼ੀ ਬਣਾ ਲਈ ਦੀ ਹੈ ਇਸ ਤਰੀਕੇ ਨਾਲ ਮਤਲਬ ਜਿਵੇਂ ਉਹਨਾਂ ਨੂੰ ਉਨ ਪਸੰਦ ਹੁੰਦਾ ਹੈ ਉਹ ਵੀ ਪੁੱਛ ਲਈਦਾ ਕਿ ਕੀ ਉਹਨਾਂ ਨੂੰ ਕੀ ਪਸੰਦ ਹੈ ਫਿਰ ਉਸ ਤਰੀਕੇ ਨਾਲ ਵੀ ਉਹਨਾਂ ਨੂੰ ਬਣਾ ਕੇ ਦੇ ਦਿੱਤਾ ਜਾਂਦਾ